ਮੈਂ ਅੰਸ਼ੁਲ ਮੈਂ ਪਠਾਨਕੋਟ ਖੇਤਰ ਦਾ ਰਹਿਣ ਵਾਲਾ ਹਾਂ ਅਤੇ ਜੇ ਮੈਂ ਗੱਲ ਕਰਾਂ ਕਿ ਮੇਰੇ ਖੇਤਰ ਵਿੱਚ ਉਭਰਨ ਵਾਲੇ ਮੁੱਖ ਕਲਾ ਰੂਪ ਅਤੇ ਸ਼ੈਲੀਆਂ ਕੀ ਹਨ ਤਾਂ ਇਸਨੂੰ ਮੈਂ ਕੁਝ ਭਾਗਾਂ ਵਿੱਚ ਵੰਡਣਾ ਚਾਹਵਾਂਗਾ ਜਿਵੇਂ ਕਿ ਪਰੰਪਰਾਗਤ ਸਮਕਾਲੀ ਸਵਦੇਸ਼ੀ ਅਤੇ ਹਾਈਬਰੀਡ ਅਤੇ ਮੇਰੇ ਖੇਤਰ ਵਿੱਚ ਉਭਰਨ ਵਾਲੇ ਮੁੱਖ ਕਲਾ ਰੂਪ ਅਤੇ ਸ਼ੈਲੀਆਂ ਜਿਵੇਂ ਕਿ ਹਨ ਜਿਵੇਂ ਕਿ ਮੈਂ ਪੰਜਾਬ 'ਚ ਰਹਿੰਦਾ ਤਾਂ ਇੱਥੋਂ ਦਾ ਸੱਭਿਆਚਾਰਿਕ ਪੰਜਾਬੀ ਹੈ ਅਤੇ ਪੰਜਾਬੀ ਕਲਚਰ ਇੱਥੇ ਜ਼ਿਆਦਾ ਮਤਲਬ ਮੁੱਖ ਕਲਾ ਰੂਪ ਵਿੱਚ ਪੇਸ਼ ਕੀਤਾ ਗਿਆ ਜਿਵੇਂ ਕਿ ਢੋਲ ਭੰਗੜਾ ਗਿੱਧਾ ਨਾਚ ਆਦਿ ਇਵੇਂ ਕਿ ਜਿਵੇਂ ਕਿ ਜੇ ਅਸੀਂ ਕੱਪੜਿਆਂ ਦੀ ਗੱਲ ਕਰੀਏ ਤਾਂ ਪੱਗ ਕੁੜਤਾ ਪਜਾਮਾ ਆਦਿ ਅਤੇ ਹੋਰ ਕੋਈ ਗੱਲ ਕਰੀਏ ਜਿੱਦਾਂ ਪੰਜਾਬੀਆਂ ਦੀ ਮੁੱਛ ਉਹਨਾਂ ਦੇ ਵੱਖਰੇ ਪਿਛ ਮਤਲਬ ਜੋ ਪਾਉਂਦੇ ਨੇ ਉਹਨਾਂ ਦਾ ਪਹਿਰਾਵਾ ਕਿੱਦਾਂ ਦਾ ਇੱਦਾਂ ਦੀ ਚੀਜ਼ਾਂ ਮੁੱਖ ਕਲਾ ਰੂਪ ਹੈ ਇੱਥੋਂ ਦਾ ਅਤੇ ਬਾਕੀ ਜੇ ਗੱਲ ਕਰੀਏ ਪੰਜਾਬੀ ਗੱਭਰੂ ਆਦਿ ਧੰਨਵਾਦ